ਹੈਲੋ ਹਾਂਜੀ ਭਾਜੀ ਹੇਅਰ ਸਟਾਈਲਿੰਗ ਤੋਂ ਬੋਲਦੇ ਹਾਂਜੀ ਭਾ ਜੀ ਕੱਟਦਾਂਗੇ ਹਾਂਜੀ ਹਾਂਜੀ ਭਾਜੀ ਹੋਜੂਗਾ ਹੋਜੂਗਾ ਰੇਟ ਭਾ ਜੀ ਕਿਆ ਕਰਾਉਣਾ ਤੁਸੀਂ ਹਾਂਜੀ ਭਾ ਜੀ ਕਿਆ ਕੁੰਡਲੇ ਕਰਾਉਣੇ ਭਾ ਜੀ ਕੁੰਡਲੇ ਅੱਠ ਸੌ ਰੁਪਇਆ ਲੱਗਣਾ ਭਾਜੀ ਕਰਾਉਣੀ ਜੇ ਡੇਢ ਸੌ ਰੁਪਇਆ ਦੇ ਦਿਓ ਭਾ ਜੀ ਹਾਂਜੀ ਸਕਰੱਬ ਕਰਦਾਂਗੇ ਕੋਈ ਨਾ ਉਹ ਵੀ ਕਰਾ ਲਿਓ ਕੋਈ ਨਾ ਆ ਜਿਓ ਤੁਸੀਂ ਦੁਕਾਨ 'ਤੇ ਹਾਂਜੀ ਭਾ ਜੀ ਇਸ ਟਾਇਮ ਮੇਰੇ ਕੋਲ ਤਿੰਨ ਚਾਰ ਗਾਹਕ ਬੈਠੇ ਵੇ ਕਸਟਮਰ ਹਾਂਜੀ ਲੱਗ ਏ ਜਾਣਾ ਅੱਧਾ ਘੰਟਾ ਪੋਣਾ ਘੰਟਾ ਲੱਗ ਏ ਜਾਣਾ ਹਾਂਜੀ ਹਾਂ ਭਾ ਜੀ ਕੋਈ ਨਾ ਕਰ ਦਵਾਂਗੇ ਕੋਈ ਨਾ ਜਾਣਾ ਤਾਂ ਨਹੀਂ ਕਿੱਥੇ ਜ਼ਰੂਰੀ ਤਾਂ ਨਹੀਂ ਤੁਹਾਨੂੰ ਕਿੱਥੇ ਜਾਣਾ ਕਿੱਥੇ ਵਈ ਅੱਛਾ ਵਿਆਹ ਵਿਉ ਆ ਕੋਈ ਚਲੋ ਕੋਈ ਨਾ ਭਾ ਜੀ ਆ ਜਿਓ ਫਿਰ ਕਰ ਦਿੰਦਾ ਤੁਹਾਡਾ ਹਾਂਜੀ ਭਾ ਜੀ ਆ ਜਿਓ ਕੋਈ ਨਾ ਦੁਕਾਨ 'ਤੇ ਹੀ ਮੈਂ ਕੋਈ ਨਾ ਮੈਨੂੰ ਫ਼ੋਨ ਕਰ ਦਿਓ ਠੀਕ ਹੈ ਚਲ ਕੋਈ ਨਾ ਭਾ ਜੀ ਕਰਦੂਂ ਕੋਈ ਨਾ ਕੋਈ ਨਾ ਮੈਨੂੰ ਫ਼ੋਨ ਕਰ ਦਿਓ ਮੈਂ ਕਿਹਾ ਜਦ ਦੁਕਾਨ 'ਤੇ ਆਉਣਾ ਨਾ ਹਾਂ ਚਾਹੇ ਤੁਸੀਂ ਹੁਣੇ ਆ ਜਾਓ ਮੈਂ ਤੁਹਾਡਾ ਕਰ ਦਿੰਦਾ ਪਹਿਲਾਂ ਕੋਈ ਨਾ ਦੁਕਾਨ ਤਾਂ ਭਾ ਜੀ ਦਸ ਵਜੇ ਤੱਕ ਹੈ ਹਾਂਜੀ ਓਕੇ ਭਾ ਜੀ ਠੀਕ